ਮੈਂ ਮੇਰੇ ਗੁਆਂਢੀ ਨੇ ਸਿਲੰਡਰ ਉਹ ਕਿਤੇ ਬਾਹਰ ਜਾਣ ਲੱਗੇ ਸੀ ਅਤੇ ਉਹਨਾਂ ਦੇ ਸਿਲੰਡਰ ਨੂੰ ਮੈਂ ਆਪਣੇ ਨਾਮ ਕਰਵਾ ਲਿਆ ਕਰਵਾਉਣਾ ਚਾਹੁੰਦਾ ਸੀ ਇਸ ਲਈ ਮੈਂ ਗੈਸ ਏਜੰਸੀ ਨੂੰ ਫੋਨ ਕੀਤਾ ਕਿ ਮੇਰੀ ਜੋ ਪਹਿਲਾਂ ਗੈਸ ਸਿਲਿੰਡਰ ਲੈਣ ਲਈ ਬੁੱਕ ਕਰ

ਕੀਤਾ ਸੀ ਉਹ ਰੱਦ ਕਰ ਦਿੱਤਾ ਜਾਵੇ ਜਿਸ ਦਾ ਹਵਾਲਾ ਨੰਬਰ ਪੰਜ ਦੋ ਸੱਤ ਤਿੰਨ ਦੋ ਇੱਕ ਹੈ ਅਤੇ ਉਹਨਾਂ ਨੇ ਮੇਰੀ ਗੱਲ ਸੁਣ ਕੇ ਮੈਨੂੰ ਇਹ ਕਿਹਾ ਕਿ ਦੋ ਤਿੰਨ ਦਿਨਾਂ ਬਾਅਦ ਤੇਰੇ ਕੰਮ ਹੋਣ ਜਾਂ ਨਾ ਹੋਣ ਬਾਰੇ ਤੈਨੂੰ ਦੱਸ ਦਿੱਤਾ ਜਾਵੇਗਾ ਇਸ ਤੋਂ ਬਾਅਦ ਉਹਨਾਂ ਨੇ ਕੁਝ ਦਿਨ ਬਾਅਦ ਮੈਨੂੰ ਫੋਨ ਕੀਤਾ ਕਿ ਤੁਹਾਡੇ ਜੋ ਸਿਲੰਡਰ ਲੈਣ ਦਾ ਰੱਦ ਹੋ ਚੁੱਕਿਆ ਹੈ ਅਤੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਮੈਂ ਚੈੱਕ ਕੀਤਾ ਅਤੇ ਮੇਰੇ ਸਿਲਿੰਡਰ ਦੀ ਦਰਖਾਸ ਰੱਦ ਹੋ ਚੁੱਕੀ ਸੀ ਥੈਂਕ ਯੂ